ਸੱਤ ਮਾਰਚ ਉੱਨੀ ਸੌ ਸਤਾਸੀ ਸਤਾਰ੍ਹਾਂ ਦੋ ਦੋ ਹਜ਼ਾਰ ਸੱਤ ਤੇਈ ਚਾਰ ਉੱਨੀ ਸੌ ਇਕਾਨਵੇਂ ਪੱਚੀ ਚਾਰ ਉੱਨੀ ਸੌ ਅਠਾਨਵੇਂ ਤੀਹ ਨਵੰਬਰ ਦੋ ਹਜ਼ਾਰ ਉੱਨੀ